ਅੱਜ ਕੱਲ ਬੈਂਕਿੰਗ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਜਿਵੇਂ ਹ ਅੱਜ ਕੱਲ ਔਨਲਾਈਨ ਬੈਂਕਿੰਗ ਚੱਲ ਗਈ ਆ ਅਤੇ ਔ ਹਰ ਹਰ ਕੰਮ ਔਨਲਾਈਨ ਹੋ ਗਿਆ ਹੈ ਅਤੇ ਪਹਿਲਾਂ ਆਪਾਂ ਬੈਂਕ 'ਚ ਜਾ ਕੇ ਇੱਕ ਦੂਜੇ ਦੇ ਸਾਹਮਣੇ ਪੈਸੇ ਟ ਪੈਸੇ ਬੈਂਕ 'ਚ ਜਮ੍ਹਾਂ ਕਰਵਾਉਂਦੇ ਸੀ ਜਾਂ ਪੈਸੇ ਕਢਵਾਉਂਦੇ ਸੀ ਪਹਿਲਾਂ ਆਪਾਂ ਨੂੰ ਬੈਂਕ 'ਚ ਜਾਣਾ ਪੈਂਦਾ ਸੀ ਪਰ ਹੁਣ ਅਸੀਂ ਘਰ ਬੈਠੇ ਪੈਸੇ ਕਢਵਾ ਸਕਦੇ ਹਾਂ ਜਮ੍ਹਾਂ ਕਰਵਾ ਸਕਦੇ ਜਾਂ ਟਰਾਂਸਫਰ ਕਰ ਸਕਦੇ ਹਾਂ ਪਰ ਸਾਨੂੰ ਕਈ ਵਾਰੀ ਇਹ ਗੱਲਾਂ ਦਾ ਵੀ ਡਰ ਲੱਗਦਾ ਕਈ ਕਈਆਂ ਨੂੰ ਜਦੋਂ ਬੈਂਕ ਪਹਿਲਾਂ ਜਦੋਂ ਬੈਂਕ 'ਚ ਜਾ ਕੇ ਕਰਵਾਉਂਦੇ ਸੀ ਹਰ ਕੰਮ ਤਾਂ ਉਹਨਾਂ ਨੂੰ ਜਦੋਂ ਨਹੀਂ ਵੀ ਆਉਂਦਾ ਸੀ ਕ ਕਈਆਂ ਨੂੰ ਬੈਂਕ ਦਾ ਕੰਮ ਪੈਸੇ ਜਮ੍ਹਾਂ ਕਰਵਾਉਣੇ ਜਾਂ ਕਢਵਾਉਣੇ ਨਹੀਂ ਆਉਂਦੇ ਸੀ ਤਾਂ ਉਸ ਤੋਂ ਹੈਲਪ ਉੱਥੇ ਬੈਂਕ ਦੇ ਜੋ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਤੋਂ ਹੈਲਪ ਲੈ ਸਕਦੇ ਹੁੰਦੇ ਸੀਗੇ ਬਟ ਹੁਣ ਜਦੋਂ ਔਨਲਾਈਨ ਕੰਮ ਚਲ ਗਿਆ ਈ ਬੈਂਕਿੰਗ ਆ ਗਈ ਤਾਂ ਹੁਣ ਕੰਮ ਕ ਹੁਣ ਡਰ ਲੱਗਦਾ ਵੀ ਕਿਤੇ ਕੋਈ ਗਲਤ ਗਲਤ ਗਲਤੀ ਨਾ ਹੋ ਜਾਵੇ ਜਿਸ ਨਾਲ ਸਾਡੇ ਪੈਸੇ ਕਿਸੇ ਹੋਰ ਕੋਲ ਨਾ ਚਲੇ ਜਾਣ ਅਤੇ ਸਾਡੇ ਪੈਸੇ ਵਿੱਚ ਅਤੇ ਸਾਡੇ ਪੈਸੇ ਕਿਸੇ ਹੋਰ ਕੋਲ ਟ੍ਰਾਂਸਫਰ ਨਾ ਹੋ ਜਾਣ ਜਾਂ ਸਾਡੇ ਪੈਸੇ ਵਿੱਚ ਸਾਨੂੰ ਸਾਡੇ ਪੈਸੇ ਮਿਲਣ ਜਾਂ ਨਾ ਮਿਲਣ ਜਾਂ ਕੋਈ ਗਲਤ ਟਰਾਂਜੈਕਸ਼ਨ ਹੋ ਜੇ ਸਾਨੂੰ ਹੁਣ ਇਸ ਗੱਲਾਂ ਦਾ ਡਰ ਲੱਗਿਆ ਰਹਿੰਦਾ ਹੈ ਵੀ ਹੁਣ ਕੁਝ ਗਲਤ ਕਦਮ ਨਾ ਚੁੱਕਿਆ ਜਾਵੇ ਅਤੇ ਗਲਤ ਨਾ ਹੋਜੇ